ਹੈਲੋ ਹੈਲੋ ਠੀਕ ਹਾਂ ਤੁਸੀਂ ਦੱਸੋ ਮੈਂ ਇੱਕ ਬੁੱਕ ਲਿਖ ਰਹੀ ਸੀਗੀ ਸਟੋਰੀ ਜਿਹੀ ਲਿਖ ਰਹੀ ਸੀਗੀ ਹਾਂ ਅੱਛਾ ਅੱਛਾ ਤੁਹਾਨੂੰ ਨਾ ਪਹਿਲਾਂ ਲਿਖਣ ਵਾਸਤੇ ਨਾ ਯੂਟਿਊਬ ਤੋਂ ਪਹਿਲਾਂ ਇੱਕ ਦੋ ਵੀਡੀਓਸ ਦੇਖ ਲਿਓ ਠੀਕ ਹੈ ਅਤੇ ਸੈਕਿੰਡ ਆਫ ਆਲ ਤੁਸੀਂ ਲਾਇਬ੍ਰੇਰੀ ਆਪਣੇ ਨਾ ਪਿੰਡ ਵਿੱਚ ਲਾਇਬ੍ਰੇਰੀ ਖੁੱਲ੍ਹੀ ਹੋਈ ਆ ਆਜ਼ਾਦ ਪਬਲਿਕੇਸ਼ਨ ਗਿੱਦੜਬਾਹਾ ਹਾਂ ਅਤੇ ਉਹ ਉਹ ਨਹੀਂ ਆ ਬੁੱਕਸ ਰੀਡ ਕਰਕੇ ਵੇਖਿਓ ਅਤੇ ਜਿਹੜਾ ਜਿਹੜਾ ਤੁਹਾਡੇ ਘਰ ਦਾ ਮਾਹੌਲ ਹੈ ਕੋਈ ਕੁਛ ਵੀ ਤੁਹਾਨੂੰ ਯਾਦ ਰਹਿੰਦਾ ਕੋਈ ਲੜਾਈ ਝਗੜੇ ਵਾਲਾ ਕੋਈ ਹਾਸੀ ਮਜ਼ਾਕ ਵਾਲਾ ਕੋਈ ਘਰ ਦੇ ਵਿੱਚ ਕੋਈ ਆਇਆ ਉਹ ਸਾਰੀਆਂ ਚੀਜ਼ਾਂ ਨੋਟ ਕਰੋ ਫਿਰ ਜੋ ਤੁਸੀਂ ਲਿਖਣਾ ਚਾਹੁੰਦੇ ਹੋ ਵੀ ਇੱਕ ਵਾਰ ਵੈਸੇ ਹੀ ਕੋਈ ਟੋਪਿਕ ਜਿਹਾ ਲਿ ਲਿਖ ਕੇ ਵੇਖੋ ਵੀ ਸਾਡੇ ਘਰ ਦੇ ਵਿੱਚ ਇਸ ਤਰ੍ਹਾਂ ਹੋ ਰਿਹਾ ਇਸ ਤਰ੍ਹਾਂ ਹੋ ਰਿਹਾ ਹੈ ਨਾ ਅਤੇ ਉਹ ਵਾਲੇ ਟੋਪਿਕ 'ਤੇ ਛੋਟਾ ਇੱਕ ਨੋਟ ਲਿਖ ਕੇ ਦੇਖੋ ਫਿਰ ਇੱਕ ਕਹਾਣੀ ਲਿਖ ਕੇ ਦੇਖੋ ਉਹ ਕਹਾਣੀ ਦੇ ਵਿੱਚੋਂ ਸਿੱਖ ਕੀ ਨਿਕਲ ਕੇ ਆ ਰਹੀ ਹੈ ਉਹ ਵੇਖੋ ਟੋਪਿਕ ਦਾ ਨਾਮ ਕੀ ਹੋਣਾ ਚਾਹੀਦਾ ਉਹ ਵੇਖੋ ਇਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਕੰਬਾਈਨ ਕਰਕੇ ਇੱਕ ਸਟੋਰੀ ਬਣ ਜਾਂਦੀ ਆ ਅੱਜ ਕੱਲ੍ਹ ਮੈਂ ਵੀ ਇੱਕ ਸਟੋਰੀ ਓ ਲਿਖੀ ਹੈ ਮੇਰਾ ਘਰ ਯੂਟੀਊਬ 'ਤੇ ਪਈ ਹੈ ਅਤੇ ਯੂ ਗੂਗਲ 'ਤੇ ਵੀ ਮਿਲ ਜੂਗੀ ਪਹਿਲਾਂ ਆਪਣੀ ਜਿਹੜਾ ਵੀ ਘਰ ਦੇ ਵਿੱਚ ਮਾਹੌਲ ਹੈ ਉਸ ਤੋਂ ਦੂਰ ਜਾਓ ਇਕਾਂਤ ਇਕਾਂਤ ਦੇ ਵਿੱਚ ਬੈਠੋ ਮੈਡੀਟੇਸ਼ਨਸ ਕਰੋ ਯੋਗਾ ਕਰੋ ਯੋਗਾ ਕਲਾਸੀਸ ਜਿਵੇਂ ਲੱਗਦੀਆਂ ਨੇ ਪਾਰਕਸ ਦੇ ਵਿੱਚ ਲੱਗਦੀਆਂ ਨੇ ਯੋਗਾ ਕਲਾਸ ਅਕੈਡਮਿਕ ਦੇ ਵਿੱਚ ਲੱਗਦੀਆਂ ਨੇ ਜਾਂ ਜਿਵੇਂ ਤੁਹਾਡੇ ਘਰ ਦੇ ਵਿੱਚ ਕੋਈ ਗਾਰਡਨ ਹੁੰਦਾ ਹੈ ਨਾ ਆਪਣੇ ਸਾਰਿਆਂ ਦੇ ਵੀ ਘਰਾਂ ਵਿੱਚ ਪੇੜ ਪੌਦੇ ਹੁੰਦੇ ਨੇ ਉਹਨਾਂ ਵਿੱਚ ਜੇ ਆਪਾਂ ਨੂੰ ਕੁਦਰਤੀ ਸਾਹ ਮਿਲੂਗਾ ਨਾ ਉਦੋਂ ਇਕਾਂਤ ਮਾਹੌਲ ਬਣੂਗਾ ਆਪਣੇ ਅੰਦਰ ਵੀ ਅਤੇ ਆਪਣੇ ਬਾਹਰ ਵੀ ਅਤੇ ਉਸ ਤਰ੍ਹਾਂ ਉਸ ਤਰ੍ਹਾਂ ਨਾ ਆਪਣੇ ਦਿਮਾਗ ਦੇ ਵਿੱਚ ਇੱਕ ਸਨਟੈਂਸ ਜਾਂ ਕੁਝ ਕਹਿ ਲਓ ਵਰਡਸ ਕਹਿ ਲਓ ਕੋਈ ਲਾਈਨ ਕਹਿ ਲਓ ਹੈ ਨਾ ਸੰਕੇਤ ਕੁਛ ਇਸ ਤਰ੍ਹਾਂ ਦੇ ਸ਼ਬਦ ਆ ਜਾਣਗੇ ਜਿਹੜੀ ਤੁਹਾਡੀ ਕਹਾਣੀ ਨੂੰ ਇੱਕ ਰੂਪ ਦੇਣਗੇ ਸ਼ਬਦਾਂ ਦਾ ਜਿਹੜਾ ਤਾਲਮੇਲ ਕਹਾਣੀ ਦਾ ਹੁੰਦਾ ਉਹ ਕਹਾਣੀ 'ਚ ਤਬਦੀਲ ਹੋਜੂਗਾ ਹਾਂ ਤੇ ਦੂਸਰਾ ਪਾਣੀ ਪੂਣੀ ਵੀ ਜ਼ਿਆਦਾ ਪੀਆ ਕਰੋ ਟੈਂਸ਼ਨ ਟੁਨਸ਼ਨ ਘੱਟ ਲਿਆ ਕਰੋ ਜਿਹੜੀ ਵੀ ਕੋਈ ਵੀ ਗੱਲ ਹੁੰਦੀ ਆ ਵੀ ਟੈਂਸ਼ਨ ਵਾਲੀ ਜਾਂ ਸਟਰੈਸ ਵਾਲੀ ਉਹਨੂੰ ਨਾ ਇੱਕ ਲਿਖ ਲਿਆ ਕਰੋ ਹਾਂ ਫਿਰ ਲਿਖ ਕੇ ਹੀ ਉਹ ਤਜਰਬੇ ਨੂੰ ਆਉਂਦਾ ਹੁੰਦਾ ਹਾਂ ਹੋਰ ਕੋਈ ਲਿਖੀ ਆ ਅੱਜ ਤੱਕ ਕਹਾਣੀ ਅੱਛਾ ਇਹ ਕਰਨ ਨੂੰ ਘੱਟ ਟਾਈਮ ਮਿਲਦਾ ਇੱਕ ਤਾਂ ਨਾ ਲਾ ਬੱਚਿਆਂ ਕਰਕੇ ਜ਼ਿੰਦਗੀ ਨਾਲ ਬਾਹਲੀ ਬਿਜ਼ੀ ਹੋਈ ਪਈ ਆ ਐਂ ਹੁੰਦਾ ਵੀ ਇਹ ਕਰ ਲਈਏ ਉਹ ਕਰ ਲਈਏ ਬੱਚਿਆਂ ਪਿੱਛੇ ਹੈ ਨਾ ਚਲੋ ਕੋਈ ਗੱਲ ਨਹੀਂ ਤੁਸੀਂ ਐਂ ਕਰਿਆ ਕਰੋ ਮੈਡੀਟੇਸ਼ਨ ਕਰਿਆ ਕਰੋ ਪਾਣੀ ਵੱਧ ਤੋਂ ਵੱਧ ਪੀਆ ਕਰੋ ਇਕੱਲੇ ਵਿੱਚ ਬੈਠਿਆ ਕਰੋ ਹੈ ਨਾ ਇਕੱਲੇ ਵਿੱਚ ਬੈਠ ਕੇ ਆ ਆਪਣੇ ਕੋਲ ਪੈਨ ਕਾਪੀ ਰੱਖਿਆ ਕਰੋ ਕੁਛ ਨਾ ਕੁਛ ਮਤਲਬ ਲਿਖਦੇ ਰਿਹਾ ਕਰੋ ਕੁਛ ਸ਼ਾਇਰੀ ਆਉਂਦੀ ਹੈ ਤੁਹਾਡੇ ਮਨ 'ਚ ਸ਼ਾਇਰੀ ਲਿਖੋ ਕਵਿਤਾ ਆਉਂਦੀ ਹੈ ਕਵਿਤਾ ਲਿਖੋ ਕਹਾਣੀ ਆਉਂਦੀ ਹੈ ਕਹਾਣੀ ਲਿਖੋ ਕੋਈ ਜੇ ਸਿੰਗਰ ਦਾ ਤੁਸੀਂ ਸੌਂਗ ਸੁਣਿਆ ਉਹ ਉਹਨਾਂ ਦੀਆਂ ਵਰਡਸ ਨੂੰ ਕੰਬਾਈਨ ਕਰਕੇ ਕੁਛ ਆਪਣੀ ਸ਼ਾਇਰੀ ਬਣਾਓ

ਕੋਈ ਹੈਗਾ ਤੁਹਾਡੇ ਨੌਨ 'ਚ ਜਿਹੜਾ ਮਤਲਬ ਸਟੋਰੀ ਰਾਈਟਰ ਵਗੈਰਾ ਕਰਦਾ ਰਾਈਟ ਕਰਦਾ ਹੋਵੇ ਅੱਛਾ ਅੱਛਾ ਠੀਕ ਹੈ ਠੀਕ ਹੈ ਚਲੋ ਠੀਕ ਹੈ ਫਿਰ ਬਾਕੀ ਕੋਈ ਮਦਦ ਲੈਣੀ ਹੋਵੇ ਤਾਂ ਫੋਨ ਕਰ ਲਿਓ ਕੋਈ ਗੱਲ ਨਹੀਂ ਹੈਗੀ ਇਸ ਤਰ੍ਹਾਂ ਦੀ ਹੈ ਨਾ ਠੀਕ ਹੈ ਜੀ ਓਕੇ